ਤਸਵੀਰਾਂ ਖਿੱਚਣਾ ਮੇਰਾ ਇੱਕ ਬਹੁਤ ਹੀ ਵੱਡਾ ਸ਼ੌਕ ਹੈ ਮੈਂ ਆਪਣੀਆਂ ਹੀ ਨਹੀਂ ਬਲਕਿ ਆਪਣੇ ਆਲੇ ਦੁਆਲੇ ਜਿੰਨੀਆਂ ਵੀ ਚੀਜ਼ਾਂ ਮੈਨੂੰ ਵਧੀਆ ਲੱਗਦੀਆਂ ਨੇ ਮੈਂ ਉਹ ਇੱਕ ਤਸਵੀਰ ਦੇ ਰੂਪ ਵਿੱਚ ਸਾਂਭ ਕੇ ਰੱਖ ਲੈਂਦੀ ਹਾਂ ਅਤੇ ਹੁਣ ਮੈਂ ਇੱਕ ਤਸਵੀਰ ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਂ ਇਹ ਪਹਿਲੀ ਤਸਵੀਰ ਆਪਣੀ ਖਿੱਚੀ ਸੀ ਜਦੋਂ ਮੈਂ ਬਾਰਾਂ ਸਾਲ ਦੀ ਹੁੰਦੀ ਸੀ ਅਤੇ ਉਦੋਂ ਸਾਡੇ ਘਰ ਇੱਕ ਕੈਮਰਾ ਆਇਆ ਸੀਗਾ ਅਤੇ ਪਹਿਲੀ ਵਾਰ ਉਹ ਕੈਮਰੇ ਦੀ ਬਹੁਤ ਹੀ ਜ਼ਿਆਦਾ ਖੁਸ਼ੀ ਸੀ ਅਤੇ ਮੈਂ ਆਪਣੇ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਕਿਹਾ ਕਿ ਜਲਦੀ ਜਲਦੀ ਤਿਆਰ ਹੋਵੋ ਚਲੋ ਆਪਾਂ ਫੋਟੋ ਖਿੱਚਾਂਗੇ ਅਤੇ ਉਦੋਂ ਮੇਰੇ ਸਾਰੇ ਪਰਿਵਾਰ ਦੇ ਮੈਂਬਰ ਤਿਆਰ ਹੋਏ ਅਤੇ ਮੈਂ ਖੁਦ ਨਵੇਂ ਕੱਪੜੇ ਪਾਏ ਸੀਗੇ ਮੇਰੇ ਭੈਣ ਭਰਾ ਸੀਗੇ ਸਾਰੇ ਛੋਟੇ ਅਤੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਇੱਕ ਫੈਮਿਲੀ ਫੋਟੋ ਖਿੱਚੀ ਸੀਗੀ ਪੂਰੇ ਪਰਿਵਾਰ ਦੇ ਮੈਂਬਰ ਉਸ ਦੇ ਵਿੱਚ ਸੀਗੇ ਅਤੇ ਉਹ ਫੋਟੋ ਸਾਡੇ ਲਈ ਇੱਕ ਯਾਦਗਾਰੀ ਦੇ ਤੌਰ 'ਤੇ ਮੈਂ ਸਾਂਭ ਕੇ ਰੱਖੀ ਹੋਈ ਹੈ ਕਿਉਂਕਿ ਕੁਛ ਕੁ ਜੀਅ ਨੇ ਜੋ ਉਹ ਤਸਵੀਰ ਦੇ ਵਿੱਚ ਸੀਗੇ ਉਸ ਵੇਲੇ ਪਰ ਹੁਣ ਮੇਰੇ ਨਾਲ ਨਹੀਂ ਹੈਗੇ ਤਾਂ ਉਨ੍ਹਾਂ ਦੀ ਵੀ ਯਾਦ ਉਹ ਫੋਟੋ ਦੇ ਵਿੱਚ ਹੈ ਜੋ ਮੈਂ ਸਾਂਭ ਕੇ ਰੱਖੀ ਹੋਈ ਹੈ ਉਹ ਫੋਟੋ ਦੇ ਵਿਚਲੀ ਖੁਸ਼ੀ ਬਹੁਤ ਹੀ ਮਤਲਬ ਵਧੀਆ ਤਰੀਕੇ ਨਾਲ ਨਜ਼ਰ ਆਉਂਦੀ ਹੈ ਕਿ ਕਿੰਨੇ ਜ਼ਿਆਦਾ ਖੁਸ਼ ਸੀ ਉਸ ਵੇਲੇ ਅਤੇ ਹੁਣ ਵੀ ਜਦੋਂ ਅਸੀਂ ਦੇਖਦੇ ਹਾਂ ਤਾਂ ਉਦੋਂ ਅਸੀਂ ਛੋਟੇ ਹੁੰਦੇ ਸੀ ਜਦੋਂ ਫੋਟੋ ਖਿੱਚੀ ਸੀ ਅਤੇ ਹੁਣ ਅਸੀਂ ਵੱਡੇ ਹੋ ਚੁੱਕੇ ਹਾਂ ਅਤੇ ਉਹ ਫੋਟੋ ਜਦੋਂ ਅਸੀਂ ਦੇਖਦੇ ਹਾਂ ਕਿ ਹਾਂ ਸਾਡੇ 'ਚ ਕਿੰਨੇ ਜ਼ਿਆਦਾ ਬਦਲਾਅ ਆਏ ਨੇ ਪਹਿਲਾਂ ਅਸੀਂ ਛੋਟੇ ਸੀ ਅਤੇ ਹੁਣ ਅਸੀਂ ਵੱਡੇ ਹੋ ਗਏ ਹਾਂ